ਖੇਡਾਂ ਵਿੱਚ ਜਦੋਂ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਅਸੀਂ ਸਫਲਤਾ ਨੂੰ ਹੋਰ ਉੱਚੇ ਮੁਕਾਮ 'ਤੇ ਲਿਜਾ ਕੇ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਜਦੋਂ ਸਾਨੂੰ ਅਸਫਲਤਾ ਮਿਲਦੀ ਹੈ ਤਾਂ ਅਸੀਂ ਬਹੁਤ ਹੀ ਨਿਰਾਸ਼ ਹੋ ਜਾਂਦੇ ਹਾਂ ਕਈ ਲੋਕ ਤਾਂ ਦੁਬਾਰਾ ਅਸਫਲਤਾ ਤੋਂ ਹਾਰ ਕੇ ਦੁਬਾਰਾ ਕੋਸ਼ਿਸ਼ ਹੀ ਨਹੀਂ ਕਰਦੇ ਉਹ ਸੋਚਦੇ ਹਨ ਕਿ ਮੈਂ ਇਸ ਵਾਰ ਅਸਫਲ ਹੋਇਆ ਹਾਂ ਕੀ ਪਤਾ ਦੁਬਾਰਾ ਵੀ ਅਸਫਲਤਾ ਮਿਲ ਸਕਦੀ ਹੈ ਇਸੇ ਡਰ ਕੇ ਉਹ ਦੁਬਾਰਾ ਕੋਸ਼ਿਸ਼ ਹੀ ਨਹੀਂ ਕਰਦੇ ਪਰ ਸਾਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਸਾਨੂੰ ਸਫਲਤਾ ਦੇ ਪ੍ਰਾ ਨਜ਼ਦੀਕ ਲੈ ਜਾਦੀ ਹੈ ਅਤੇ ਸਾਨੂੰ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਕੇ ਹੌਲੀ ਹੌਲੀ ਉਸ ਨੂੰ ਬਿਹਤਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਫਲਤਾ ਦੇ ਹੋਰ ਨਜ਼ਦੀਕ ਲੈ ਕੇ ਜਾਂਦੀ ਹੈ ਇਸੇ ਕੋਸ਼ਿਸ਼ ਕਰਦੇ ਸਾਨੂੰ ਅਸਫਲਤਾ ਤੋਂ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸਾਨੂੰ ਕੋਸ਼ਿਸ਼ ਕਰਨਾ ਨਹੀਂ ਛੱਡਣਾ ਚਾਹੀਦਾ